ਸਾਡੇ ਪਿੰਡ ਵਿੱਚ ਬਹੁਤ ਹੀ ਵੱਡੇ ਵੱਡੇ ਬੂਟੀਕ ਹਨ ਜਿੱਥੇ ਵੱਖ ਵੱਖ ਹਿੱਸਿਆਂ 'ਚੋਂ ਲੋਕ ਆ ਕੇ ਸੂਟ ਸਿਲਾਈ ਕਰਕੇ ਲੈ ਕੇ ਜਾਂਦੇ ਹਨ ਕਿਉਂਕਿ ਸਾਨੂੰ ਮੋਹਾਲੀ ਸ਼ਹਿਰ ਲੱਗਦਾ ਹੈ ਜਿੱਥੇ ਡਿਫਰੈਂਟ ਡਿਫਰੈਂਟ ਡਿਜ਼ਾਇਨ ਦੇ ਸੂਟ ਤਿਆਰ ਕੀਤੇ ਜਾਂਦੇ ਹਨ ਅਤੇ ਮੈਂ ਵੀ ਇੱਕ ਵਾਰ ਸਿਲਾਈ ਕਢਾਈ ਦਾ ਕੰਮ ਤਿਆਰ ਕੀਤਾ ਸੀਗਾ ਅਤੇ ਬਟ ਮੇਰਾ ਪਲੈਨ ਚੇਂਜ ਹੋਣ ਕਾਰਨ ਮੈਂ ਉਹ ਚੀਜ਼ਾਂ ਛੱਡ ਦਿੱਤੀਆਂ ਅਤੇ ਮੈਂ ਵੀ ਬਹੁਤ ਤਰ੍ਹਾਂ ਦੇ ਅਲੱਗ ਅਲੱਗ ਰਿਵਾਜ ਦੇ ਕੱਪੜੇ ਤਿਆਰ ਕਰ ਕਰਕੇ ਲੋਕਾਂ ਨੂੰ ਦਿੱਤੇ ਹਨ ਅਤੇ ਸਪੈਸ਼ਲੀ ਸਾਡਾ ਪੰਜਾਬ ਵੀ ਹੈ ਜਿਹੜਾ ਸੂਟਾਂ ਦੇ ਨਾਂ ਨੂੰ ਜਾਣਿਆ ਜਾਂਦਾ ਹੈ ਵੱਖ ਵੱਖ ਤਰੀਕਿਆਂ ਨੂੰ ਅਤੇ ਜਿਹੜੇ ਸੂਟ ਨਹੀਂ ਪਾ ਸਕਦੇ ਉਹਨਾਂ ਲਈ ਡਿਫਰੈਂਟ ਸਟਾਈਲ ਦੇ ਹੋਰ ਬਥੇਰੇ ਚੀਜ਼ਾਂ ਆ ਜਾਂਦੀਆਂ ਜਿਵੇਂ ਕਿ ਪਲਾਜੋ ਹੋ ਗਿਆ ਕੁੜਤੀ ਸਟਾਈਲ ਸੂਟ ਹੋ ਗਿਆ ਇੱਦਾਂ ਦੀਆਂ ਚੀਜ਼ਾਂ ਇਨਵੈਂਟ ਕੀਤੀਆਂ ਜਾਂਦੀਆਂ ਹਨ ਜੋ ਕਿ ਡਿਫਰੈਂਟ ਸਟਾਈਲ ਲੋਕਾਂ ਨੂੰ ਬੜਾ ਪਸੰਦ ਆਉਂਦਾ ਲੋਕ ਉਹਨੂੰ ਪਾਉਣ ਲਈ ਬਹੁਤ ਹੀ ਜ਼ਿਆਦਾ ਤ ਖੁਸ਼ ਹੋ ਕੇ ਅਲੱਗ ਅਲੱਗ ਬੁਟੀਕਸ 'ਤੇ ਜਾ ਕੇ ਉਹ ਦਿੰਦੇ ਹਨ ਮੈਂ ਵੀ ਇੱਕ ਬੂਟੀਕ ਆ ਸੇਖੋਂ ਬੂਟੀਕ ਜਿੱਥੇ ਜਾ ਕੇ ਮੈਂ ਆਪਣੇ ਸੂਟ ਤਿਆਰ ਕਰਵਾਉਂਦੀ ਹਾਂ ਅਤੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ਼ ਸੂਟ ਸਟਿੱਚ ਕਰਦੀ ਹੈ ਅਤੇ ਵਧ ਡਿਜ਼ਾਇਨ ਨਾਲ ਤਿਆਰ ਕਰਦੀ ਹੈ